ਹਾਂਜੀ ਅਸੀਂ ਯੋਗਾ ਦੀ ਕਲਾਸ ਲਗਾਈ ਹੈ ਅਤੇ ਉਸ ਵਿੱਚ ਸਾਨੂੰ ਬਹੁਤ ਹੀ ਫਾਇਦਾ ਮਿਲਦਾ ਹੈ ਯੋਗ ਗੁਰੂ ਰਾ ਗੁਰੂ ਰਾਮਦਾਸ ਅਤੇ ਪੂਰਨੀਮਾ ਹੈ ਅਤੇ ਇਹ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਯੋਗਾ ਕਰਵਾਉਂਦੇ ਹਨ ਅਤੇ ਅਸੀਂ ਪ੍ਰਭਾਵਿਤ ਹੋ ਕੇ ਕਰਦੇ ਹਨ ਔਰ ਇਸ ਪੇਟ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹਨ ਇਸਦਾ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਸਨ ਕਰਦੇ ਹਨ ਅਤੇ ਔਰ ਸਾਡੇ ਹੋਰ ਸਰੀਰ ਦੀ ਔਰ ਬਿਮਾਰੀਆਂ ਤੋਂ ਵੀ ਅਸੀਂ ਮੁਕਤ ਹੁੰਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ